ਜੀ ਅਸੀਂ ਗੈਸ ਬੁਕਿੰਗ ਕਰਵਾਇਆ ਸੀਗਾ ਹੈਲੋ ਜੀ ਅਸੀਂ ਗੈਸ ਬੁਕਿੰਗ ਕਰਵਾਇਆ ਸੀਗਾ ਜੀ ਤੁਸੀਂ ਜੀ ਭਾਰ ਘੱਟ ਹੈ ਜੀ ਗੈਸ ਦਾ ਜੀ ਅਸੀਂ ਪੈਸੇ ਵੀ ਪੂਰੇ ਦਿੰਦੇ ਤੁਸੀਂ ਤਾਂ ਵੀ ਜੀ ਤੁਹਾਨੂੰ ਤੁਸੀਂ ਘੱਟ ਦਿੱਤਾ ਸਾਨੂੰ ਗੈਸ ਦਾ ਜੀ ਤੁਸੀਂ ਪੈਸੇ ਵੀ ਵੱਧ ਲੈਂਦੇ ਹੋ ਗੈਸ ਵੀ ਤੁਸੀਂ ਘੱਟ ਦਿੰਦੇ ਹੋ ਤੁਸੀਂ ਸਹੀ ਭਰਿਆ ਕਰੋ ਨਾ ਜੀ ਤੁਸੀਂ ਤੋਲ ਕੇ ਜੀ ਤੁਸੀਂ ਤੋਲ ਕੇ ਦਿਆ ਕਰੋ ਨਾ ਸਿਲੰਡਰ ਤੁਸੀਂ ਐਵੇਂ ਨਾ ਦਿਆ ਕਰੋ ਨਹੀਂ ਜੀ ਅਸੀਂ ਚਲਾਇਆ ਸੀ ਸਿਲੰਡਰ ਜੀ ਚੱਲਿਆ ਨਹੀਂ ਨਹੀਂ ਜੀ ਸਹੀ ਆ ਉਹਦੀ ਗੈਸ ਵਿਚ ਹੀ ਖ਼ਰਾਬੀ ਐ ਜੀ ਅਸੀਂ ਬਦਲਾਅ ਕੇ ਜਾਵਾਂਗੇ ਗੈਸ ਜੀ ਘੱਟ ਹੈ ਬਹੁਤ ਜ਼ਿਆਦੇ ਜੀ ਠੀਕ ਜੀ ਆ ਜਾਵਾਂਗੇ ਅਸੀਂ ਫਿਰ ਜੀ ਜੀ ਠੀਕ ਆ ਜੀ ਜੀ ਬੁਡਾ ਗੁੱਜਰ ਤੋਂ ਹੈ ਜੀ ਸਾਡਾ ਤਾਂ ਜੀ ਆ ਜਾਵਾਂਗੇ ਅਸੀਂ ਜੀ ਆ ਜਾਵਾਂਗੇ

ਹਾਂਜੀ ਜੀ ਅਸੀਂ ਆ ਜਾਵਾਂਗੇ ਫਿਰ ਬਦਲਾਅ ਕੇ ਜਾਵਾਂਗੇ ਕੱਲ੍ਹ ਨੂੰ ਜੀ